ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਅਤੇ ਬੜੇ ਹੀ ਧੂਮਧਾਮ ਨਾਲ ਮਨਾਏ ਜਾਂਦੇ ਹਨ ਦਿਵਾਲੀ ਈਦ ਵਿਸਾਖੀ ਹੋਲੀ ਇਹ ਸਭ ਤਿਉਹਾਰ ਤਾਂ ਬਹੁਤ ਧੂਮਧਾਮ ਨਾਲ ਮਨਾਏ ਜਾਂਦੇ ਹਨ ਅਤੇ ਬਿਨਾਂ ਕਿਸੇ ਦੇ ਧਰਮ ਨੂੰ ਵੇਖਦੇ ਹੋਏ ਬੜੇ ਹੀ ਭਾਈਚਾਰੇ ਨਾਲ ਆਹ ਤਿਉਹਾਰ ਮਨਾਏ ਜਾਂਦੇ ਹਨ ਮਗਰ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦੋ ਹੋਰ ਤਿਉਹਾਰ ਮਨਾਏ ਜਾਂਦੇ ਹਨ ਜਿਹੜੇ ਕਿ ਕਿਸੇ ਹੋਰ ਜ਼ਿਲ੍ਹੇ ਵਿੱਚ ਵੀ ਮਨਾਏ ਨਹੀਂ ਜਾਂਦੇ ਜਿਵੇਂ ਕਿ ਗਰਮੀਆਂ ਵਿੱਚ ਆਉਣ ਵਾਲਾ ਜੁਲਾਈ ਦੇ ਮਹੀਨੇ ਆਉਣ ਵਾਲਾ ਸਾਵਣ ਦਾ ਮਹੀਨਾ ਸਾਵਣ ਦੇ ਮਹੀਨੇ ਦੇ ਵਿੱਚ ਨਵੇਂ ਵਿਆਹੇ ਜੋੜੇ ਸੀਤਲਾ ਮੰਦਰ ਦੁਰਗਿਆਨਾ ਮੰਦਰ ਵੀ ਕਿਹਾ ਜਾਂਦਾ ਹੈ ਜਿਹਨੂੰ ਉੱਥੇ ਜਾਂਦੇ ਹਨ ਜਨਾਨੀਆਂ ਪੂਰਾ ਸਾਜ ਸ਼ਿੰਗਾਰ ਫੁੱਲਾਂ ਦਾ ਕਰਦੀਆਂ ਹਨ ਫੁੱਲਾਂ ਦਾ ਮਾਂਗ ਟਿੱਕਾ ਗਹਿਣੇ ਪਾ ਕੇ ਉੱਥੇ ਆਪਣੇ ਜੋੜੇ ਨਾਲ ਮੱਥਾ ਟੇਕਦੀਆਂ ਹਨ ਅਤੇ ਇੱਕ ਹੋਰ ਤਿਉਹਾਰ ਜਿਹੜਾ ਕਿ ਦੁਸਹਿਰੇ ਵੇਲੇ ਨਵਰਾਤਰਿਆਂ ਵਿੱਚ ਆਉਂਦਾ ਹੈ ਜਿਹਦੇ ਵਿੱਚ ਜਿਹਨਾਂ ਦੇ ਘਰ ਪੁੱਤਰ ਨਹੀਂ ਹੁੰਦੇ ਉਹਨਾਂ ਨੇ ਸੁੱਖਿਆ ਹੁੰਦਾ ਹੈ ਕਿ ਜਦੋਂ ਪੁੱਤਰ ਹੋਏਗਾ ਅਸੀਂ ਉਸਨੂੰ ਲੰਗੂਰ ਬਣਾਵਾਂਗੇ ਅਤੇ ਜਦੋਂ ਪੁੱਤਰ ਹੋ ਜਾਂਦਾ ਹੈ ਉਸ ਨੂੰ ਉਹ ਲੰਗੂਰ ਬਣਾਉਂਦੇ ਹਨ ਜਿਹੜਾ ਕਿ ਪਹਿਲੇ ਨਵਰਾਤਰੇ ਤੋਂ ਲੈ ਕੇ ਰਾਮਨੌਮੀ ਤੱਕ ਚੱਲਦਾ ਹੈ ਉਹ ਲੰਗੂਰ ਬਣਾਉਣ ਦਾ ਮਕਸਦ ਹੈ ਕਿ ਉਹਨੂੰ ਹਨੂੰਮਾਨ ਜੀ ਦਾ ਮੰਦਰ ਜਿਹੜਾ ਕਿ ਸ਼ੀਤਲਾ ਮੰਦਰ ਮਤਲਬ ਦੁਰਗਿਆਨਾ ਮੰਦਰ ਦੇ ਵਿੱਚ ਹੈ ਉੱਥੇ ਮੱਥਾ ਟਿਕਾਣਾ ਪੂਰੇ ਦੱਸ ਦਿਨ ਭੁੰਝੇ ਸੋਣਾ ਕੱਟਿਆ ਵੱਡਿਆ ਨਾ ਖਾਣਾ ਜਿਸ ਤਰ੍ਹਾਂ ਹਨੂੰਮਾਨ ਜੀ ਬ੍ਰਹਮਚਾਰੀ ਰਹੇ ਉਸ ਤਰ੍ਹਾਂ ਹੀ ਉਨੇ ਦਿਨ ਉਸਨੇ ਉਸ ਪੂਰੇ ਤਰ੍ਹਾਂ ਉਹਦਾ ਪਾਲਨ ਪੋਸ਼ਣ ਕਰਨਾ ਇਹ ਦੋ ਤਿਉਹਾਰ ਕਿਤੇ ਹੋਰ ਸ਼ਹਿਰ 'ਚ ਨਹੀਂ ਮਨਾਏ ਜਾਂਦੇ ਅਤੇ ਅੰਮ੍ਰਿਤਸਰ ਵਿੱਚ ਇਹ ਸਾਰੇ ਹੀ ਤਿਉਹਾਰ ਲੋਹੜੀ ਦਿਵਾਲੀ ਵਿਸਾਖੀ ਦਾ ਮੇਲਾ ਲੱਗਦਾ ਹੈ ਬਹੁਤ ਹੀ ਧੂਮਧਾਮ ਨਾਲ ਮਨਾਏ ਜਾਂਦੇ ਹਨ